ਹੈਲੋ ਸਤਿ ਸ਼੍ਰੀ ਅਕਾਲ ਜੀ ਮੈਨੂੰ ਨਾ ਐਕਚੁਲੀ ਮੇਰੀ ਫਰੈਂਡ ਨੇ ਨਾ ਹੋਮ ਰੈਨੋਵੈਟ ਕਰਵਾਉਣ ਲਈ ਰਿਕਮੈਂਡ ਕੀਤਾ ਸੀ ਅਤੇ ਉਹਦੇ ਰਿਲੈਟੇਡ ਮੈਂ ਮਤਲਬ ਆਪਦਾ ਘਰ ਨਿਊ ਈਅਰ ਲਈ ਰੈਨੂਵੇਟ ਕਰਾਉਣਾ ਸੀ ਮੈਂ ਡਿਜਾਨਸ ਲਭ ਰਹੀ ਸੀ ਸੋ ਫੇਰ ਮੈਨੂੰ ਤੁਹਾਡਾ ਨੰਬਰ ਮਿਲਿਆ ਸੀ ਅਤੇ ਮੈ ਤੁਹਾਡੇ ਤੋਂ ਰੈਨੋਵੈਸ਼ਨ ਕਰਵਾਉਣੀ ਸੀ ਕਿ ਤੁਸੀਂ ਕਰਵਾ ਸਕਦੇ ਹੋ ਓਕੇ ਤ ਅ ਅਕਚੁਲੀ ਮੈਨੂੰ ਉਹਨਾਂ ਨੇ ਕਾਫੀ ਡਿਜ਼ਾਇਨ ਭੇਜੇ ਉਹਨਾਂ 'ਚੋਂ ਮੈਨੂੰ ਡਿਜ਼ਾਇਨ ਕਾਫੀ ਪਸੰਦ ਆਏ ਸੀ ਅਤੇ ਉਹ ਮੈਂ ਤੁਹਾਨੂੰ ਸੈਂਡ ਕਰੂੰਗੀ ਉਸ ਹਿਸਾਬ ਨਾਲ ਤੁਸੀਂ ਡਿਸਾਈਡ ਕਰ ਲਿਓ ਬਾਕੀ ਇੱਕ ਵਾਰੀ ਤੁਸੀਂ ਆ ਕੇ ਦੇਖ ਜਾਇਓ ਕਿਉਂਕਿ ਮੈਂ ਮਤਲਬ ਫੁੱਲ ਫਰਨਿਸ਼ਡ ਹਾਂ ਪੂਰੇ ਘਰ ਨੂੰ ਕਰਨਾ ਡਿਜ਼ਾਇਨ ਰੈਨੋਵੈਸ਼ਨ ਕਰਵਾਉਣੀ ਜ਼ਰੂਰੀ ਹਾਂਜੀ ਇੱਕ ਵਾਰ ਤੁਸੀਂ ਆ ਕੇ ਦੇਖ ਜਾਇਓ ਮੈਂ ਡਿਜ਼ਾਇਨ ਵੈਸੇ ਤੁਹਾਨੂੰ ਸੈਂਡ ਕਰ ਦੂੰਗੀ ਹਾਂਜੀ ਬਾਕੀ ਬਜਟ ਤੁਹਾਡਾ ਕਿੰਨਾ ਹੋ ਸਕਦਾ ਨਿਅਰ ਅਬਾਉਟ ਠੀਕ ਹੈ ਫਿਰ ਮਤਲਬ ਤੁਸੀਂ ਕਦੋਂ ਤੱਕ ਫ੍ਰੀ ਹੋ ਵਿਜਿਟ ਕਰ ਸਕਦੇ ਹੋ ਘਰ ਮਤਲਬ ਨਯੂ ਇਅਰ ਦੇ ਨਿਆਰ ਅਬਾਉਟ ਮੈਂ ਕਰਵਾਉਣਾ ਰੈਨੋਵੈਟ ਅਤੇ ਮਤਲਬ ਇੱਕ ਦੋ ਦਿਨ ਤੱਕ ਤੁਸੀਂ ਵਿਜਿਟ ਕਰ ਜਾਇਓ ਵੇਖ ਜਾਇਓ ਅਤੇ ਆਪਣਾ ਬਜਟ ਵੀ ਦੱਸ ਜਾਇਓ ਹਾਂਜੀ ਹਾਂਜੀ ਫਿਰ ਬਾਕੀ ਮੈਂ ਤੁਹਾਨੂੰ ਡਿਜਾਇਨਸ ਵੇਖ ਕੇ ਠੀਕ ਹੈ ਸਭ ਕੁਝ ਦੱਸ ਦੂੰਗੀ ਜਿਵੇਂ ਮੈਨੂੰ ਮਤਲਬ ਇੱਕ ਕਿਚਨ ਵਿੱਚ ਜਿਵੇਂ ਟਾਇਲਸ ਦਾ ਕੰਮ ਚਾਹੀਦਾ ਮੈਨੂੰ ਹਾਫ ਜਿਵੇਂ ਹਾਫ ਮਤਲਬ ਕਿ ਇੱਕ ਵਾਰਡ ਹੀ ਹੋਏਗੀ ਅਤੇ ਹਾਲਫ ਉਹ ਅਤੇ ਮਤਲਬ ਟਾਇਲਸ ਦਾ ਕੰਮ ਵੀ ਹੋ ਸਕੇ ਜਿਸ ਤਰ੍ਹਾਂ ਦੇ ਰੈਨੋਵੇਸ਼ਨ ਚਾਹੀਦਾ ਮੈਨੂੰ ਕਿਚਨ 'ਚ ਰੂਮ 'ਚ ਮਤਲਬ ਪੂਰਾ ਟਾਇਲਸ ਦਾ ਕੰਮ ਚਾਹੀਦਾ ਅਤੇ ਹਾਂਜੀ ਹਾਂਜੀ ਓਕੇ ਜੀ ਠੀਕ ਹੈ ਥੈਂਕ ਯੂ ਵੈਰੀ ਮਚ ਹਾਂਜੀ